ਟੈਕਨਾਲੋਜੀ ਕਾਰਨ ਸਾਡੇ ਮਨੋਰੰਜਨ ਦੇ ਸਾਧਨਾਂ ਵਿੱਚ ਬਹੁਤ ਬਦਲਾਅ ਆਇਆ ਟੈਕਨਾਲੋਜੀ ਦੇ ਕਾਰਨ ਹੀ ਬਹੁਤ ਸਾਰੀਆਂ ਅਜਿਹੀਆਂ ਖ ਅਜਿਹੀਆਂ ਖੇਡਾਂ ਹਨ ਜੋ ਅਸੀਂ ਪਹਿਲਾਂ ਘਰਾਂ ਵਿੱਚ ਰਹਿ ਕੇ ਖੇਡਦੇ ਸੀ ਹੁਣ ਅੱਜ ਦੇ ਸਮੇਂ ਵਿੱਚ ਅਸੀਂ ਮੋਬਾਇਲ ਫ਼ੋਨ ਜਾਂ ਕੰਪਿਊਟਰਾਂ ਉੱਤੇ ਖੇਡ ਸਕਦੇ ਹਾਂ ਟੈਕਨਾਲੋਜੀ ਦੇ ਕਾਰਨ ਹੀ ਸਾਨੂੰ ਦੂਰ ਦੁਰਾਡੇ ਦੀਆਂ ਖਬਰਾਂ ਖਬਰਾਂ ਜਾਂ ਹੋਣ ਵਾਲੇ ਘਟਨਾਕ੍ਰਮਾਂ ਦੀਆਂ ਜਾਣਕਾਰੀ ਮਿੰਟਾਂ ਸਕਿੰਟਾਂ ਵਿੱਚ ਪ੍ਰਾਪਤ ਹੋ ਜਾਂਦੀ ਹੈ ਜੋ ਕਿ ਪਹਿਲਾਂ ਵਾਲੇ ਸਮਿਆਂ ਵਿੱਚ ਅਜਿਹਾ ਨਹੀਂ ਹੁੰਦਾ ਸੀ ਪਹਿਲਾਂ ਵਾਲਿਆਂ ਸਮਿਆਂ ਵਿੱਚ ਜਾਣਕਾਰੀ ਸਾਨੂੰ ਰੇਡੀਓ ਜਾਂ ਟੈਲੀਵਿਜ਼ਨਾਂ 'ਤੇ ਜਾਂ ਅਗਲੇ ਦਿਨ ਦੀ ਛਪਣ ਵਾਲੀ ਅਖਬਾਰ ਵਿੱਚੋਂ ਹੀ ਪ੍ਰਾਪਤ ਹੁੰਦੀ ਸੀ ਉਸ ਤੋਂ ਬਾਅਦ ਰਹੀ ਗੱਲ ਮੋਬਾਇਲ ਫ਼ੋਨ 'ਤੇ ਵੀਡਿਓ ਦੇਖਣ ਅਤੇ ਸੁਣਨ ਦੀ ਤਾਂ ਇਸਨੇ ਸਾਡੇ ਜੀਵਨ ਪੱਧਰ ਨੂੰ ਬਹੁਤ ਉੱਚਾ ਚੱਕਿਆ ਹੈ ਸਾਨੂੰ ਪਲ਼ ਪਲ਼ ਦੀ ਹਰ ਦੇਸ਼ ਵਿਦੇਸ਼ ਦੀ ਜਾਣਕਾਰੀ ਮਿੰਟਾਂ ਸਕਿੰਟਾਂ ਵਿੱਚ ਸਾਡੇ ਮੋਬਾਇਲ ਫ਼ੋਨ 'ਤੇ ਇੰਟਰਨੈੱਟ ਸੁਵਿਧਾ ਕਾਰਨ ਪ੍ਰਾਪਤ ਹੁੰਦੀ ਹੈ ਜਿਸ ਕਾਰਨ ਅਸੀਂ ਘਰ ਬੈਠੇ ਹੀ ਪੂਰੀ ਦੁਨੀਆ ਨਾਲ ਕਨੈਕਟਿਡ ਰਹਿ ਸਕਦੇ ਹਾਂ ਇਸ ਤੋਂ ਇਲਾਵਾ ਜਿੱਥੇ ਹਰ ਚੀਜ਼ ਦੇ ਸਕਾਰਾਤਮਕ ਨਤੀਜੇ ਹੁੰਦੇ ਹਨ ਉੱਥੇ ਨਕਾਰਾਤਮਕ ਅਹ ਨਕਾਰਾਤਮਕ ਹੋਣਾ ਵੀ ਸੁਭਾਵਿਕ ਹੈ ਇਸਨੇ ਸਾਨੂੰ ਟੈਕਨਾਲੋਜੀਕਰਨ ਨੇ ਸਾਨੂੰ ਆਪਣੇ ਪਰਿਵਾਰ ਤੋਂ ਦੂਰ ਕਰ ਦਿੱਤਾ ਹੈ ਪਰਿਵਾਰ ਵਿੱਚ ਰਹਿ ਕੇ ਵੀ ਪਰਿਵਾਰ ਤੋਂ ਦੂਰ ਕਰ ਦਿੱਤਾ ਹੈ ਅਜਿਹੇ ਹੋਰ ਵੀ ਬਹੁਤ ਸਾਰੇ ਨਕਾਰਾਤਮਕ ਕਾਰਨ ਹਨ ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ